ਜੀ ਬਿਲਕੁਲ ਮੈਂ ਸੋਚਦੀ ਹਾਂ ਕਿ ਮੇਰੀਆਂ ਪੇਂਟਿੰਗਾਂ ਦੂਜਿਆਂ ਨੂੰ ਬਹੁਤ ਪ੍ਰਭਾਵਿਤ ਕਰਦੀਆਂ ਹਨ ਕਿਉਂਕਿ ਮੇਰੀ ਜੋ ਵੀ ਚਿੱਤਰਕਾਰੀ ਹੁੰਦੀ ਹੈ ਉਹ ਹਰ ਇੱਕ ਚਿੱਤਰਕਾਰੀ ਦੇ ਮਗਰ ਇਕ ਅਰਥ ਛੁਪਿਆ ਹੁੰਦਾ ਹੈ ਜਿਸ ਨਾਲ ਕਿ ਆਪਾਂ ਨੂੰ ਆਪਣੇ ਕਲਚਰ ਦੇ ਨਾਲ ਜੁੜਿਆ ਰਹਿਣਾ ਚਾਹੀਦਾ ਹੈ ਜਿਵੇਂ ਕਿ ਰਾਜਸਥਾਨੀ ਡ੍ਰੈਸ ਉਹਨਾਂ ਦੇ ਅਲੱਗ ਅਲੱਗ ਡਾਂਸ ਦੇ ਚਿੱਤਰ ਜਿਹੜੇ ਕਿ ਆਪਾਂ ਆਪਣੇ ਕਲਚਰ ਦੇ ਨਾਲ ਜੁੜੇ ਰਹਿਣ ਲਈ ਦੱਸਦੇ ਹਨ ਅਤੇ ਜਦੋਂ ਵੀ ਮੈਂ ਆਪਣੀਆਂ ਪੇਂਟਿੰਗਸ ਨੂੰ ਦੇਖਦੀ ਹਾਂ ਤਾਂ ਮੈਨੂੰ ਬਹੁਤ ਹੀ ਖੁਸ਼ੀ ਮਹਿਸੂਸ ਹੁੰਦੀ ਹੈ ਕਿਉਂਕਿ ਇਹ ਲੋਕਾਂ ਨੂੰ ਬਹੁਤ ਸੋਹਣੀਆਂ ਲੱਗਦੀਆਂ ਹਨ ਜਿਨ੍ਹਾਂ ਦੇ ਮਗਰ ਇਕ ਮਤਲਬ ਛੁਪਿਆ ਰਹਿੰਦਾ ਹੈ ਇੱਕ ਅਰਥ ਜੋ ਆਪਾਂ ਨੂੰ ਹਮੇਸ਼ਾਂ ਕੁਛ ਨਾ ਕੁਛ ਯਾਦ ਦਵਾਉਂਦਾ ਰਹਿੰਦਾ ਹੈ ਕਿ ਆਪਾਂ ਨੂੰ ਇੱਦਾਂ ਦਾ ਕੁਛ ਕਰਨਾ ਚਾਹੀਦਾ ਹੈ ਅਤੇ ਜੋ ਵੀ ਆਦਮੀ ਜਾਂ ਔਰਤ ਇਸਨੂੰ ਪੇਂਟ ਕਰਦਾ ਹੈ ਅਤੇ ਇਹਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਰੰਗ ਯੂਸ ਕਰਦੇ ਹੈ ਜੋ ਕਿ ਆਪਾਂ ਨੂੰ ਦੇਖਦੇ ਹੀ ਦੂਰੋਂ ਹੀ ਪ੍ਰਭਾਵਿਤ ਕਰਨ ਲੱਗ ਜੀਆ ਲੱਗ ਜਾਂਦੀਆਂ ਹਨ ਅਟਰੈਕਟ ਕਰਦੇ ਹਨ ਆਪਣੇ ਵੱਲ ਕਿ ਆਪਾਂ ਇਹਨਾਂ ਨੂੰ ਦੇਖੀਏ ਜਿਨਾਂ ਨਾਲ ਆਪਣਾ ਕੋਨਫੀਡੈਂਸ ਵੀ ਬੂਸਟ ਹੁੰਦਾ ਹੈ ਕਿ ਆਪਾਂ ਇਸ ਤੋਂ ਬਾਅਦ ਹੋਰ ਵੀ ਕੁਛ ਅਲੱਗ ਨਵਾਂ ਬਣਾ ਸਕਦੇ ਹਾਂ